ਅਸੀਂ ਲੋਕਡੌਨ ਵਿੱਚ ਚੀਜ਼ਾਂ ਬਣਾਉਣੀਆਂ ਸਿੱਖੀਆਂ ਜਿਵੇਂ ਕਿ ਜਲੇਬੀਆਂ ਕਿਉਂਕਿ ਸਾਡੇ ਘਰਦਿਆਂ ਨੂੰ ਜਲੇਬੀਆਂ ਬਹੁਤ ਹੀ ਪਸੰਦ ਨੇ ਇਸ ਲਈ ਅਸੀਂ ਖ਼ਾਸ ਤੌਰ 'ਤੇ ਜਲੇਬੀਆਂ ਬਣਾਉਣੀਆਂ ਸਿੱਖੀਆਂ ਫਿਰ ਅਸੀਂ ਬੱਚਿਆਂ ਨੂੰ ਗੁਲਾਬ ਜਾਮਣ ਬਹੁਤ ਪਸੰਦ ਸੀ ਅਸੀਂ ਗੁਲਾਬ ਜਾਮਣ ਵੀ ਬਣਾਉਣੇ ਸਿੱਖੀ ਫੋਨ ਤੋਂ ਵਟਸਐਪ ਤੋਂ ਕੱਢ ਕੇ ਗੁਲਾਬ ਜਾਮਣ ਬਣਾਉਣੇ ਸਿੱਖੇ ਜਿਵੇਂ ਕਿ ਨਮਕੀਨ ਬੱਚਿਆਂ ਨੂੰ ਵੀ ਬਹੁਤ ਪਸੰਦ ਹੁੰਦਾ ਹੈ ਮਨਚੁਰੀਅਨ ਜੋ ਕਿ ਸਬਜ਼ੀਆਂ ਲੈ ਕੇ ਅਸੀਂ ਉਹ ਵੀ ਬਣਾਉਣਾ ਸਿੱਖਿਆ ਜਿਵੇਂ ਕਿ ਸਪਰਿੰਗ ਰੋਲ ਹੋਏ ਫਿਰ ਅਸੀਂ ਲੇਜ ਬਣਾਉਣੇ ਸਿੱਖੇ ਆਲੂਆਂ ਦੇ ਕੱਟ ਕੇ ਬੱਚਿਆਂ ਨੂੰ ਬਹੁਤ ਹੀ ਪਸੰਦ ਆਏ ਬਹੁਤ ਹੀ ਮਜ਼ੇ ਨਾਲ ਖਾਧੇ ਅਤੇ ਲੋਕਡੌਨ ਵਿੱਚ ਸਾਰੇ ਘਰਦਿਆਂ ਨੇ ਸਾਰੀ ਫੈਮਿਲੀ ਨੇ ਰਲ ਕੇ ਸਾਡਾ ਸਾਥ ਦਿੱਤਾ ਇਸ ਲਈ ਅਸੀਂ ਲੋਕਡੌਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਸਿੱਖ ਲਈਆਂ ਅਤੇ ਅਸੀਂ ਸਾਡੇ ਘਰ ਜਦੋਂ ਗੈਸਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਚੀਜ਼ਾਂ ਬਣਾ ਕੇ ਇਹ ਸਾਰੀਆਂ ਖਵਾਉਂਦੇ ਹਾਂ